ਪੰਜਾਬ ਵਿੱਚ ਜਿਹੜੇ ਬੈਂਕ ਹਨ ਉਹਨਾਂ ਕੋਲੋਂ ਕ੍ਰੈਡਿਟ ਕਾਰਡ ਇੱਕ ਜਾਂ ਬੀਮਾ ਪੋਲਸੀਆਂ ਜਾਂ ਲੋਨ ਇਸ਼ੂ ਕੀਤੇ ਜਾਂਦੇ ਹਨ ਇਹ ਕ੍ਰੈਡਿਟ ਕਾਰਡ ਮੈਂ ਗੱਲ ਕਰਦਾ ਜੇ ਕ੍ਰੈਡਿਟ ਕਾਰਡ ਦੀ ਤਾਂ ਕ੍ਰੈਡਿਟ ਕਾਰਡ ਇੱਕ ਬਹੁਤ ਹੀ

ਇਸ ਤਰ੍ਹਾਂ ਹੀ ਇੱਕ ਲੋਨ ਹੁੰਦਾ ਹੈ ਲੋਨ ਵੀ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਅਤੇ ਬੈਂਕ ਵੱਲੋਂ ਲੋਨ ਅੱਗੇ ਜਿਹਨੂੰ ਵੀ ਦਿੱਤਾ ਜਾਂਦਾ ਹੈ ਉਹਦੀਆਂ ਕਿਸ਼ਤਾਂ ਬਣਾ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਕਾਰ ਲੋਨ ਕਿਸੇ ਨੇ ਲੈਣਾ ਹੈ ਪ੍ਰੋਪਰਟੀ ਲੋਨ ਲੈਣਾ ਹੈ ਕਿਸੇ ਨੇ ਬੈਂਕ ਬੈਂਕ 'ਚੋਂ ਆਪਣੇ ਮਕਾਨ ਬਣਾਉਣ ਲਈ ਲੋਨ ਲੈਣਾ ਹੈ ਅਤੇ ਉਸ ਨੂੰ ਉਸ ਹਿਸਾਬ ਨਾਲ ਉਹਦੀਆਂ ਕਿਸ਼ਤਾਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਵੀ ਇੱਕ ਬਹੁਤ ਹੀ ਚੰਗਾ ਇੱਕ ਤਰੀਕਾ ਹੈ ਪੈਸੇ ਬੈਂਕ ਤੋਂ ਲੈਣ ਦਾ ਤਾਂ ਕਿ ਆਪਣਾ ਉਹ ਡੇਲੀ ਰੂਟੀਨ ਵਰਕ ਹੈ ਜਾਂ ਫਿਰ ਆਪਣਾ ਬਾਕੀ ਦਾ ਜਿਹੜਾ ਕੰਮ ਹੈ ਉਹ ਨਾਲ ਨਾਲ ਹੁੰਦਾ ਰਵੇ ਅਤੇ ਨਾਲ ਹੀ ਆਪਣਾ ਕੋਈ ਕਾਰ ਲੈਣਾ ਹੈ ਕਿਸੇ ਨੇ ਪਲੈਨ ਕੀਤੀ ਹੈ ਜਾਂ ਕਿਸੇ ਨੇ ਘਰ ਬਣਾਉਣਾ ਪਲੈਨ ਕੀਤਾ ਉਹ ਵੀ ਨਾਲ ਨਾਲ ਕੰਮ ਚਲਦਾ ਰਵੇ ਇੱਦਾਂ ਹੀ ਬੀਮਾ ਪੋਲਸੀਆਂ ਹਨ ਬੀਮਾ ਪੋਲਸੀਆਂ ਇੱਕ ਤਰ੍ਹਾਂ ਤਰ੍ਹਾਂ ਦੀਆਂ ਅਵੇਲੇਬਲ ਹਨ ਜੋ ਕਿ ਤੁਹਾਨੂੰ ਲਾਈਫ ਇੰਸ਼ੋਰੈਂਸ਼ ਸਕੀਮਸ ਹੈਗੀਆਂ ਨੇ ਟਰਮ ਪਲੈਨਸ ਹੈਗੇ ਨੇ ਯੂਲੀ ਪਲੈਨਸ ਹੈਗੇ ਨੇ ਉਹ ਤੁਸੀਂ ਅਲੱਗ ਅਲੱਗ ਆਪਣੇ ਕ੍ਰੈਡਿਟ ਦੇ ਹਿਸਾਬ ਨਾਲ ਤੁਸੀਂ ਆ ਉਹਨਾਂ ਨੂੰ ਲੈ ਸਕਦੇ